ਮੇਰੀ ਜ਼ਿੰਦਗੀ ਦੇ ਵਿੱਚ ਕੁਝ ਪ੍ਰਾਪਤੀਆਂ ਮੇਰੀ ਮੇਰੀ ਖੇਡਾਂ ਅਤੇ ਸਿੱਖਿਆਵਾਂ ਨੂੰ ਲੈ ਕੇ ਹਨ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਗੋਲ ਬਣਾਏ ਹਨ ਉਹਨਾਂ ਨੂੰ ਪੂਰਾ ਕਰਨ ਲਈ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਜਦੋਂ ਮੇਰੇ ਟਵੇ ਟੈਂਨਥ ਕਲਾਸ 'ਚੋਂ ਨੰਬਰ ਬਹੁਤ ਘੱਟ ਆਏ ਸੀ ਤਾਂ ਮੈਂ ਆਪਣੇ ਮੰਮੀ ਡੈਡੀ ਨੂੰ ਪ੍ਰੋਮਿਸ ਕੀਤਾ ਸੀ ਕਿ ਟਵੈਲਥ ਕਲਾਸ 'ਚੋਂ ਮੇਰੇ ਅੱਸੀ ਪ੍ਰਸੈਂਟ ਤੋਂ ਜ਼ਿਆਦਾ ਨੰਬਰ ਆਉਣਗੇ ਅਤੇ ਮੈਂ ਇਗਜ਼ਾਮ ਟਾਈਮ ਪੂਰੀ ਲਗਨ ਨਾਲ ਮਿਹਨਤ ਕੀਤੀ ਸੀ ਅਤੇ ਇਗਜ਼ਾਮ ਦੇਣ ਤੋਂ ਬਾਅਦ ਮੈਂ ਆਪਣੇ ਰਿਜਲਟ ਲਈ ਬਹੁਤ ਐਕਸਾਈਟਿਡ ਸੀ ਅਤੇ ਜਦੋਂ ਮੇਰਾ ਰਿਜ਼ਲਟ ਆਇਆ ਤਾਂ ਮੇਰੇ ਏਟ ਅੱਸੀ ਅਠਾਸੀ ਪ੍ਰਸੈਂਟ ਨੰਬਰ ਆਏ ਸੀ ਅਤੇ ਜਦੋਂ ਮੈਂ ਮੰਮੀ ਡੈਡੀ ਨੂੰ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ ਅਤੇ ਮੈਂ ਵੀ ਬਹੁਤ ਖੁਸ਼ ਹੋਇਆ